ਜੇ ਗੱਲ ਕਰੀਏ ਤਾਂ ਬੁਣਾਈ ਵਿੱਚ ਸਭ ਤੋਂ ਵੱਧ ਕੋਟੀਆਂ ਅਤੇ ਟੋਪੀਆਂ ਬੁਣੀਆਂ ਜਾਂਦੀਆਂ ਹਨ ਅਤੇ ਸਿਲਾਈ ਵਿੱਚ ਸੂਟ ਪਲਾਜੋ ਕੁੜਤਾ ਪਜਾਮਾ ਬਣਾਏ ਜਾਂਦੇ ਹਨ ਕੋਟੀਆਂ ਅਤੇ ਟੋਪੀਆਂ ਠੰਢ ਤੋਂ ਬਚਣ ਲਈ ਬਣਾਏ ਜਾਂਦੇ ਹੈ ਅਤੇ ਇਹ ਉੱਨ ਦੀ ਵਰਤੋਂ ਨਾਲ ਬਣਾਏ ਜਾਂਦੇ ਹਨ ਇਹਨਾਂ ਵਿੱਚ ਆਪਾਂ ਆਪਣੀ ਮਨ ਮਰਜ਼ੀ ਦੇ ਡਿਜ਼ਾਈਨ ਬਣਾ ਸਕਦੇ ਹਾਂ ਅਤੇ ਇਸ ਅਤੇ ਇਹ ਜਿਸ ਮਰਜ਼ੀ ਦੇ ਬਣਾ ਸਕਦੇ ਹਾਂ ਜਿਵੇਂ ਕਿ ਬਜ਼ੁਰਗ ਬੱਚੇ ਜਵਾਨ ਆਦਿ ਲਈ ਇਹ ਬਣਾ ਕੇ ਬਹੁਤ ਸੋਹਣੇ ਲੱਗਦੇ ਹਨ ਅਤੇ ਸਭ ਇਹਨਾਂ ਨੂੰ ਬਹੁਤ ਸ਼ੌਂਕ ਨਾਲ ਪਾਉਂਦੇ ਹਨ ਅਤੇ ਸਭ ਪਸੰਦ ਕਰਦੇ ਹਨ ਮੈਨੂੰ ਜਵਾਕਾਂ ਦੇ ਸਵੈਟਰ ਬਣਾਉਣਾ ਬਹੁਤ ਪਸੰਦ ਹਨ ਅਤੇ ਮੈਂ ਜਵਾਕਾਂ ਦੇ ਸਵੈਟਰ ਦੇ ਡਿਜਾਇਨ ਅਤੇ ਮੂੰਹ ਬਣਾਏ ਮੂੰਹ ਬਣਾਏ ਜੋ ਬਹੁਤ ਵਧੀਆ ਬਣੇ ਅਤੇ ਜਵਾਕਾਂ ਨੂੰ ਬਹੁਤ ਪਸੰਦ ਆਏ ਅਤੇ ਉਹਨਾਂ ਬਹੁਤ ਸ਼ੌਂਕ ਨਾਲ ਪਾਏ ਸੂਟ ਸਾਡਾ ਪੰਜਾਬੀਆਂ ਦਾ ਪਹਿਰਾਵਾ ਹੈ ਇਸ ਕਰਕੇ ਸੂਟ ਸਿਲਾਈ ਕੀਤੇ ਜਾਂਦੇ ਹਨ ਸੂਟ ਸਿਲਾਈ ਕਰਨ ਲਈ ਮੋਟਰ ਦੀ ਮਸ਼ੀਨ ਨਾਲ ਕੰਮ ਕੀਤਾ ਜਾਂਦਾ ਹੈ ਉਸ ਨਾਲ ਬਹੁਤ ਤੇਜ਼ੀ ਨਾਲ ਕੰਮ ਹੁੰਦਾ ਹੈ ਅਤੇ ਜੋ ਕੰਮ ਘੰਟੇ ਵਿੱਚ ਹੋਣਾ ਹੁੰਦਾ ਹੈ ਉਹ ਪੰਦਰ੍ਹਾਂ ਮਿੰਟਾਂ ਵਿੱਚ ਕਰ ਦਿੰਦਾ ਹੈ ਅਤੇ ਇ ਇਸਦੇ ਨਾਲ ਕੰਮ ਬਹੁਤ ਸਫਾਈ ਆਉਂਦੀ ਹੈ